ਸਾਡੇ ਖੇਤਰ ਵਿੱਚ ਕਾਫੀ ਲੋਕ ਗੀਤ ਹਨ ਅਤੇ ਕਾਫੀ ਕਾਫੀ ਫੇਮਸ ਸਿੰਗਰਸ ਨੇ ਜਿਹੜੇ ਸਿੰਗਿੰਗ ਕਰਕੇ ਸਾਡ ਆਪਣਾ ਕੰਮ ਨਾਮ ਕਮਾਉਂਦੇ ਨੇ ਅਤੇ ਕੰਮ ਕਰਦੇ ਨੇ ਜਿਵੇਂ ਕਾਫੀ ਵਧੀਆ ਸਿੰਗਰ ਨੇ ਜਿਵੇਂ ਬਾਦਸ਼ਾਹ ਜਿਵੇਂ ਕਿੰਗ ਜਿਵੇਂ ਅਰਿਜੀਤ ਸਿੰਘ ਨੇਹਾ ਕੱਕੜ ਇਹਨਾਂ ਨੂੰ ਕਾਫੀ ਲੋਕਪ੍ਰਿਅ ਇੱਥੇ ਪਸੰਦ ਕੀਤਾ ਜਾਂਦਾ ਹੈ ਸਿੰਗਿੰਗ ਦੇ ਖੇਤਰ ਵਿੱਚ ਸਿੰਗਿੰਗ ਕਾਫੀ ਵਧੀਆ ਹੈ ਅਤੇ ਇਸ ਜਿਹੜਾ ਵੀ ਸਿੰਗਿੰਗ ਸੁਣਦਾ ਹੈ ਉਹਨੂੰ ਕਾਫੀ ਵਧੀਆ ਲੱਗਦਾ ਹੈ ਅਤੇ ਜਿਵੇਂ ਅਸੀਂ ਇੱਕ ਕ ਕੁਛ ਵੀ ਕਰ ਸਕਦੇ ਹਾਂ ਜਿਵੇਂ ਸਿੰਗਿੰਗ ਹੈਗੀ ਸਿੰਗਿੰਗ ਜਿਹੜਾ ਬੰਦਾ ਸਿੰਗਿੰਗ ਕਰਦਾ ਉਹ ਦਾ ਗਲੀਆ ਵੱਧ ਗਲਾ ਵਧੀਆ ਹੋਣਾ ਚਾਹੀਦਾ ਉਹਦ ਉਹਦੀ ਆਵਾਜ਼ ਪਿਆਰੀ ਹੋਣੀ ਚਾਹੀਦੀ ਹੈ ਅਤੇ ਅੱਜ ਕੱਲ੍ਹ ਸਿੰਗਿੰਗ ਵਿੱਚ ਕਾਫੀ ਨਵੀਂ ਨਵੀਂ ਟੈਕਨੋਲੋਜੀ ਆ ਗਈਆਂ ਜਿਵੇਂ ਜਿਹਦੀ ਕੋਈ ਜਿ ਜਿਹੜੀ ਕਿਸੇ ਦੀ ਆਵਾਜ਼ ਕੋਈ ਵਧੀਆ ਨਾ ਹੋਵੇ ਉਹ ਓਟੋ ਟਿਊਨ ਲਾ ਕੇ ਆਪਣੀ ਅਵਾਜ਼ ਨੂੰ ਹੋਰ ਵਧੀਆ ਕਰ ਸਕਦਾ ਹੈ ਅਤੇ ਨਾਮ ਕਮਾ ਸਕਦਾ ਹੈ ਜਿਹੜੇ ਪੇਰੈਂਟਸ ਆਪਣੇ ਬੱਚੇ ਨੂੰ ਕਹਿੰਦੇ ਹੈ ਕਿ ਤੁਸੀਂ ਤੁਹਾਨੂੰ ਸਿੰਗਰ ਨਹੀਂ ਬਣਨਾ ਚਾਹੀਦਾ ਇਹਦੇ ਵਿੱਚ ਅੱਗੇ ਸਕੋਪ ਨਹੀਂ ਹੈਗਾ ਤਾਂ ਉਹਨਾਂ ਨੂੰ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਸਿੰਗਿੰਗ ਜੇ ਤੁਹਾਡੇ ਬੱਚੇ ਵਿੱਚ ਸਿੰਗਿੰਗ ਦਾ ਟੈਲੈਂਟ ਹੈਗਾ ਤਾਂ ਉਹਨੂੰ ਕਦੇ ਵੀ ਸਿੰਗਿੰਗ ਕਰਨ ਤੋਂ ਨਹੀਂ ਰੋਕਣਾ ਚਾਹੀਦਾ ਅਤੇ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਕਿ ਤੁਸੀਂ ਸਿੰਗਰ ਬਣ ਸਕਦੇ ਹੋ ਕਿਉਂਕਿ ਜਿਹੜੇ ਬੰਦੇ ਕੋਲ ਟੈਲੈਂਟ ਹੈਗਾ ਸਾਨੂੰ ਉਹਦਾ ਟੈਲੈਂਟ ਵੇਸਟ ਨਹੀਂ ਕਰਨਾ ਚਾਹੀਦਾ ਅਤੇ ਉਹਨੂੰ ਹੋਰ ਐਪਰੀਸ਼ੀਏਟ ਸਗੋਂ ਉਹਨੂੰ ਹੋਰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਅਸੀਂ ਇਹ ਕਰ ਰਹੇ ਹਾਂ ਕਿ ਤੁਹਾਨੂੰ ਇਹ ਕਰਨਾ ਚਾਹੀਦਾ ਇੱਥੇ ਜਾਣਾ ਚਾਹੀਦਾ ਕਿਉਂਕਿ ਕਾਫੀ ਵੱਡੇ ਵੱਡੇ ਟੂਰਨਾਮੈਂਟਸ ਹੁੰਦੇ ਨੇ ਸਿੰਗਿੰਗ ਦੇ ਵੀ ਜਿਵੇਂ ਇੰਡੀਆ ਸਭ ਤੋਂ ਵੱਡਾ ਸਿੰਗਿੰਗ ਦਾ ਟੂਰਨਾਮੈਂਟ ਹੈਗਾ ਇਹ ਇੰਡੀਅਨ ਆਈਡਲ ਉੱਥੇ ਤੁਹਾਨੂੰ ਪੈਸਾ ਨਾ ਫੇਮ ਸਭ ਕੁਝ ਮਿਲ ਸਕਦਾ ਅਤੇ ਮੈਂ ਇਹੀ ਕਹਾਂਗਾ ਜਿਹਨੂੰ ਇਹ ਸਿੰਗਿੰਗ ਆਉਂਦੀ ਹੈ ਉਹ ਆਪਣਾ ਟੈਲੈਂਟ ਵੇਸਟ ਨਾ ਕਰੇ ਅਤੇ ਉਹ ਆਪਣਾ ਟੈਲੈਂਟ ਕਿਤੇ ਨਾ ਕਿਤੇ ਸ਼ੋ ਕਰੇ ਅਤੇ ਉਹਨੂੰ ਨਾਮ ਅਤੇ ਸਭ ਕੁਛ ਮਿਲੂਗਾ ਬਸ ਆਪਣੀ ਮਿਹਨਤ ਜਾਰੀ ਰੱਖੇ